ਹੈਲੋ ਇਹ ਪੀਜਾ ਹਾਟ ਜੀ ਸਰ ਮੈਂ ਬਲਵੰਤ ਰਾਜ ਸੁਜਾਨਪੁਰ ਤੋਂ ਬੋਲ ਰਿਹਾ ਮੇਰੇ ਲੜਕੇ ਦਾ ਦੱਸਵੀਂ ਦਾ ਰਿਜਲਟ ਆਇਆ ਅਤੇ ਉਹ ਅੱਛੇ ਨੰਬਰਾਂ ਨਾਲ ਪਾਸ ਹੋ ਗਿਆ ਅਤੇ ਮੈਂ ਚਾਹੁੰਦਾ ਕਿ ਘਰ ਵਿੱਚ ਇੱਕ ਛੋਟੀ ਜਿਹੀ ਪਾਲਟੀ ਅਰੇਂਜ ਕਰਾਂ ਅਤੇ ਤੁਹਾਡੇ ਪੀਜ਼ੇ ਦੇ ਰਾਹੀਂ ਮੈਂ ਬੱਚਿਆਂ ਨੂੰ ਪਾਲਟੀ ਦੇਵਾਂ ਕੀ ਤਸੀਂ ਮੈਨੂੰ ਕੋਈ ਪੀਜ਼ੇ 'ਤੇ ਕਨਸ਼ੈਕਸ਼ਨ ਜਾਂ ਕੋਈ ਛੂਟ ਦੇਵੋਗੇ ਜੇ ਦੇਵੋਗੇ ਤਾਂ ਮੇਰੇ ਪਲੀਜ ਮੇਰੇ ਨੰਬਰ 'ਤੇ ਚੁਰਾਨਵੇਂ ਛੇ ਸੌ ਚਾਲੀ ਸਤਾਹਟ ਪੰਜ ਸੌ ਚੌਵੀ 'ਤੇ ਹੁਣੇ ਕਾਲ ਕਰਕੇ ਦੱਸੋ ਜੀ